ਜੋ ਨਿਊਜ਼ ਮੀਡੀਆ ਹੈ ਉਹ ਸਾਡੇ ਕਾਰੋਬਾਰ ਨੂੰ ਕਾਫੀ ਵੱਡੇ ਪੱਧਰ 'ਤੇ ਜੋ ਏ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ ਕਿਉਂਕਿ ਨਿਊਜ਼ ਵਿੱਚ ਖਬਰਾਂ ਵਿੱਚ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਦੱਸਿਆ ਜਾਂਦਾ ਹੈ ਜਾਂ ਨਵੇ ਨਵੇਂ ਉਦਯੋਗ ਜੋ ਸਥਾਪਿਤ ਸਰਕਾਰਾਂ ਵੱਲੋਂ ਜਾਂ ਵੱਡੇ ਬਿਜ਼ਨਸਮੈਨਾਂ ਵੱਲੋਂ ਕੀਤੇ ਜਾਂਦੇ ਹਨ ਜਿਹਨਾਂ ਦਾ ਲਾਹਾ ਛੋਟੇ ਪੱਧਰ 'ਤੇ ਜੋ ਬਿਜਨਸਮੈਨ ਹੈ ਉਹ ਲੈ ਸਕਦੇ ਹਨ ਜਿਹਨਾਂ ਦੀ ਜਾਣਕਾਰੀ ਨਿਊਜ਼ ਮੀਡੀਆ 'ਤੇ ਕਾਫੀ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਅਤੇ ਜੋ ਕਿਸਾਨ ਅਤੇ ਛੋਟੇ ਉਦਯੋਗਾਂ ਨੂੰ ਵਿੱਤੀ ਸਲਾਹ ਦੇਣ ਲਈ ਕਾਫੀ ਸਰਕਾਰ ਵਲ ਸਰਕਾਰਾਂ ਵੱਲੋਂ ਜੋ ਪ੍ਰੋਗਰਾਮ ਚਲਾਏ ਜਾਂਦੇ ਹਨ ਜਿਹਨਾਂ ਲਈ ਸਾਨੂੰ ਨਿਊਜ਼ ਦੇਖਣ ਦੀ ਬਹੁਤ ਜ਼ਿਆਦਾ ਲੋੜ ਹੈ ਖੇਤੀਬਾੜੀ ਮਾਹਰ ਜੋ ਕਿਸਾਨਾਂ ਨੂੰ ਵਧੀਆਂ ਸਲਾਹਾਂ ਦਿੰਦੇ ਹਨ ਅਤੇ ਵੱਡੇ ਵੱਡੇ ਉਦਯੋਗਪਤੀ ਜੋ ਨਿਊਜ਼ ਮੀਡੀਆ ਵਿੱਚ ਆਪਣੇ ਭਾਸ਼ਣ ਨਾਲ ਲੋਕਾਂ ਨੂੰ ਸੰਬੋਧਨ ਕਰਦੇ ਹਨ ਜਿਹਨਾਂ ਕਰਕੇ ਅਸੀਂ ਜੋ ਆਪਣੇ ਕਾਰੋਬਾਰ ਨੂੰ ਵਧੀਆ ਵਿਕਸਿਤ ਕਰ ਸਕਦੇ ਹਨ ਅਤੇ ਆਪਣੇ ਕਾਰੋਬਾਰ ਨੂੰ ਵੱਡੇ ਪੱਧਰ 'ਤੇ ਵਧਾ ਸਕਦੇ ਹਾਂ